ਅੱਠ ਫਰਵਰੀ ਉੱਨੀ ਸੌ ਸੱਤਰ ਦਸ ਅਕਤੂਬਰ ਉੱਨੀ ਸੌ ਬਿਆਸੀ ਛੇ ਜਨਵਰੀ ਉੱਨੀ ਸੌ ਚਰੱਨਵੇ ਪੰਦਰਾਂ ਨਵੰਬਰ ਦੋ ਹਜ਼ਾਰ ਤੇਈ ਦਸ ਫਰਵਰੀ ਉੱਨੀ ਸੌ ਵੀਹ